ਹੈਲੋ ਹਾਂ ਕਿਵੇਂ ਯਾਰ ਹਾਂ ਮੈਂ ਵੀ ਵਧੀਆ ਮੇਰੀ ਗੱਲ ਸੁਣੀ ਮੈਨੂੰ ਤੇਰੇ ਨਾਲ ਇੱਕ ਕੰਮ ਸੀਗਾ ਮੈਂ ਨਾ ਹੁਣੇ ਹੁਣੇ ਨਵੇਂ ਅਪਾਰਟਮੈਂਟ ਦੇ ਵਿੱਚ ਸ਼ਿਫਟ ਹੋਈ ਹਾਂ ਅਤੇ ਮੈਂ ਨਾ ਆਹਾ ਆਪਦਾ ਸਾਰਾ ਮਤਲਬ ਕਿ ਐਡਰੈਸ ਵਗੈਰਾ ਚੇਂਜ ਕਰਾਉਣਾ ਹੈ ਅਤੇ ਮੇਰਾ ਹੁਣ ਮਤਲਬ ਕਿ ਮੇਰਾ ਹੁਣ ਦਾ ਐਡਰੈਸ ਹੈਗਾ ਖਾਈਫੇਮੇ ਕਿ ਮੇਰਾ ਫੋਨ ਨੰਬਰ ਵਨ ਟੂ ਥ੍ਰੀ ਫੋਰ ਫਾਈਵ ਸਿਕਸ ਸੈਵਨ ਏਟ ਨਾਈਨ ਟੈਨ ਅਤੇ ਮੇਰੀ ਈਮੇਲ ਆਈਡੀ ਕੌਰ ਅਰਪਨਦੀਪ ਐਟ ਦੀ ਰੇਟ ਨੌ ਸੌ ਚੋਦ੍ਹਾਂ ਜੀ ਮੇਲ ਡੋਟ ਕੋਮ ਅਤੇ ਮੈਂ ਤੈਨੂੰ ਇਹ ਕਹਿਣਾ ਸੀਗਾ ਕਿ ਮੈਨੂੰ ਪਤਾ ਹੈ ਕਿ ਵੀ ਤੇਰੇ ਪਾਪਾ ਬਿਜਲੀ ਬੋਰਡ ਦੇ ਵਿੱਚ ਲੱਗੇ ਹੋਏ ਆ ਸੋ ਮੈਨੂੰ ਤੇਰੇ ਨਾਲ ਇਹੀ ਕੰਮ ਸੀਗਾ ਕਿ ਵੀ ਤੂੰ ਨਾ ਆਪਦੇ ਪਾਪਾ ਤੋਂ ਮੈਨੂੰ ਪੁੱਛ ਕੇ ਅਤੇ ਦੱਸ ਦੇ ਅਤੇ ਤੂੰ ਮੈਨੂੰ ਨਾ ਮੇਰੀ ਇਹ ਸਭ ਚੇਂਜ ਕਰਨ ਦੇ ਵਿੱਚ ਐਡਰੈਸ ਚੇਂਜ ਕਰਨ 'ਚ ਮੇਰੀ ਹੈਲਪ ਕਰ ਦੇ ਤੂੰ ਆਪਦੇ ਪਾਪਾ ਨੂੰ ਪੁੱਛ ਦੇ ਇਸ ਬਾਰੇ ਅਤੇ ਉਹ ਮੇਰਾ ਸਾਰਾ ਐਡਰੈਸ ਵਗੈਰਾ ਚੇਂਜ ਕਰਵਾ ਦੇ ਮੈਂ ਆਪਦੇ ਪਿਛਲੇ ਵਾਲਾ ਜਿਹੜਾ ਬਿਜਲੀ ਬਿਜਲੀ ਵਾਲਾ ਹੈਗਾ ਸੀਗਾ ਜੋ ਵੀ ਕਨੈਕਸ਼ਨ ਉਹ ਮੈਂ ਚੇਂਜ ਕਰਵਾਉਣਾ ਹੁਣ ਅਤੇ ਤੇਰੇ ਪਾਪਾ ਤਾਂ ਹੁਣ ਜਿਵੇਂ ਬਿਜਲੀ ਮਹਿਕਮੇ ਦੇ ਵਿੱਚ ਲੱਗੇ ਹੀ ਹੋਏ ਆ ਅਤੇ ਤੂੰ ਮੈਨੂੰ ਇਹ ਸਾਰੀਆਂ ਅਪਡੇਟ ਲੈ ਕੇ ਮੈਨੂੰ ਦੇ ਦਈ ਨਾਲੇ ਮੇਰੀ ਹੈਲਪ ਕਰਦੀ ਇਸ ਸਭ ਦੇ ਵਿੱਚ ਦੋ ਦਿਨ ਪਹਿਲਾਂ ਹੀ ਹਲੇ ਮੈਂ ਸ਼ਿਫਟ ਹੋਈ ਹਾਂ ਉਹ ਵੀ ਕੰਪਨੀ ਦੇ ਥਰੂ ਅਤੇ ਤੂੰ ਮੈਨੂੰ ਇਸ ਬਾਰੇ ਆਪਦੇ ਪਾਪਾ ਤੋਂ ਪਤਾ ਕਰਕੇ ਅਤੇ ਮੈਨੂੰ ਦੱਸ ਦਈ ਬਾਕੀ ਮੈਂ ਉਂਝ ਤੈਨੂੰ ਦੱਸ ਹੀ ਦਿੱਤਾ ਆਪਦਾ ਪਤਾ ਫੋਨ ਨੰਬਰ ਅਤੇ ਈਮੇਲ ਵਗੈਰਾ ਅਤੇ ਬਾਕੀ ਮੈਂ ਤੈਨੂੰ ਵਟਸਐਪ ਕਰ ਦਉਂਗੀ ਬਾਕੀ ਅਗਰ ਤੈਨੂੰ ਇੱਦਾਂ ਹੋਇਆ ਕਿ ਵੀ ਹਾਂ ਵੀ ਤੂੰ ਜ਼ਿਆਦਾ ਇਨਫੋਰਮੇਸ਼ਨ ਮੈਨੂੰ ਨਹੀਂ ਲੈ ਕੇ ਦੇ ਸਕਦੀ ਤਾਂ ਤੂੰ ਮੈਨੂੰ ਦੱਸ ਦਈ ਕਿ ਵੀ ਮੈਂ ਆਨਲਾਈਨ ਫੋਰਮ ਕਿਸ ਵੈਬਸਾਈਟ 'ਤੇ ਜਾ ਕੇ ਵਿਜਿਟ ਕਿਸ ਵੈਬਸਾਈਟ 'ਤੇ ਵੀਜਿਟ ਕਰਾਂ ਹੈ ਨਾ ਇਹ ਸਾਰਾ ਕੁਛ ਮੈਨੂੰ ਪੁੱਛ ਕੇ ਦੱਸ ਦਈ ਫਿਰ ਮੈਂ ਵੈਬਸਾਈਟ 'ਤੇ ਵਿਜ਼ਿਟ ਕਰਕੇ ਆਪਦਾ ਆਨਲਾਈਨ ਫੋਮ ਭਰਵਾ ਲਉਂਗੀ ਥੈਂਕ ਯੂ